ਮੈਂ ਉਹਨਾਂ ਲੋਕਾਂ ਨੂੰ ਇਹ ਸਲਾਹ ਦਵਾਂਗੀ ਕਿ ਆਪਣਾ ਪੈਸਾ ਜਿਆਦਾ ਤੋਂ ਜਿਆਦਾ ਇੰਸ਼ੋਰੈਂਸ ਵਿੱਚ ਲਗਾਣ ਗੋਲਡ ਵਿੱਚ ਲਗਾਣ ਇਨਵੈਸਟਮੈਂਟ ਕਰਨ ਕੋਈ ਪਲੋਟ ਲੈਣ ਫਲੈਟ ਲੈਣ ਤਾਂ ਕਿ ਉਹਨਾਂ ਦਾ ਪੈਸਾ ਆਉਣ ਵਾਲੇ ਟਾਈਮ ਵਿੱਚ ਵਧੇ ਫੁੱਲੇ ਇੰਸ਼ੋਰੈਂਸ ਕਰਾਣ ਦਾ ਵੀ ਬਹੁਤ ਬੈਨੀਫਿਟ ਇਨਸ਼ੋਰੈਂਸ ਦੇ ਬੈਨੀਫਿਟ ਜਾਣ ਕੇ ਲੋਕ ਬਹੁਤ ਹੈਰਾਨ ਹੋਣਗੇ ਕੀ ਇੱਕ ਫੈਮਿਲੀ 'ਚ ਜੇ ਕੋਈ ਮੇਨ ਬੰਦਾ ਕਮਾਉਣ ਵਾਲਾ ਚਲੇ ਜਾਂਦਾ ਹ ਉਹ ਫੈਮਿਲੀ ਰੁਲ ਜਾਂਦੀ ਜੇ ਆਪਾਂ ਇਨਸ਼ੋਰੈਂਸ ਕਰਵਾਉਂਦੇ ਆਂ ਤੇ ਉਹ ਫੈਮਲੀ ਨੂੰ ਇੰਸ਼ੋਰੈਂਸ ਕੰਪਨੀ ਐਨ ਐਨੀ ਹੈਲਪ ਕਰਦੀ ਹੈ ਕਿ ਉਹਦੇ ਆਉਣ ਵਾਲਾ ਟਾਈਮ ਆਸਾਨੀ ਨਾ ਨਿਕਲ ਜਾਂਦਾ ਜੇ ਆਪਾਂ ਗੋਲਡ ਵੀ ਲੈ ਕੇ ਰੱਖਦੇ ਆ ਤਾਂ ਔਖੇ ਵੇਲੇ ਗੋਲਡ ਦੇ ਵੀ ਆਪਾਂ ਨੂੰ ਬਹੁਤ ਫਾਇਦੇ ਹਨ ਗੋਲਡ ਆਪਾਂ ਗਿਰਵੀ ਧਰ ਕੇ ਲੋਨ ਲੈ ਸਕਦੇ ਆਂ ਕਿਸੇ ਵੀ ਪ੍ਰੋਬਲਮ ਦਾ ਹੱਲ ਆਪਾਂ ਕਰ ਸਕਦੇ ਆਂ ਜੇ ਆਪਣੇ ਕੋਲ ਪੈਸਾ ਹ ਤਾਂ ਇਨਸ਼ੋਰੈਂਸ ਗੋਲਡ ਵਿੱਚ ਵੀ ਲਗਾਣਾ ਚਾਹੀਦਾ ਹੈ ਹੋ ਸਕੇ ਤਾਂ ਕੋਈ ਪਲੋਟ ਖਰੀਦ ਲਓ ਕੋਈ ਫਲੈਟ ਖਰੀਦ ਲਓ ਜਾਂ ਕੋਈ ਮਕਾਨ ਖਰੀਦ ਕੇ ਰੈਂਟ ਤੇ ਚੜਾ ਦੋ ਉਹ ਵੀ ਤੁਹਾਨੂੰ ਆਪਣੀ ਸਾਰੀ ਜ਼ਿੰਦਗੀ ਇਨਕਮ ਆਂਦੀ ਰਹੇਗੀ ਜਿਹੜੀ ਵੀ ਕਮਾਈ ਆਪਣੇ ਅੱਛੇ ਜਗਹਾ ਵੱਲ ਲਗਾਓ ਤਾਂ ਕਿ ਆਉਣ ਵਾਲਾ ਟਾਈਮ ਸੌਖਾ ਹੋਵੇ